ਅਸੀਂ ਹਰੇਕ ਹੀ ਸੱਭਿਆਚਾਰ ਤਿਉਹਾਰ ਮਨਾਉਂਦੇ ਹਾਂ ਜਿਵੇਂ ਕਿ ਹੋਲੀ ਲੋਹੜੀ ਦਿਵਾਲੀ ਦਿਵਾਲੀ ਵਾਲੇ ਦਿਨ ਅਸੀਂ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ ਅਤੇ ਘਰਾਂ ਦੀ ਸਫਾਈ ਕਰਕੇ ਘਰਾਂ ਦੀ ਸਜਾਵਟ ਕਰਦੇ ਹਾਂ ਸਜਾਵਟ ਕਰਦੇ ਸਮੇਂ ਹੀ ਬਹੁਤ ਹੀ ਸ ਘਰ ਸਾਫ਼ ਸੁਥਰਾ ਕਰਦੇ ਹਾਂ ਅਤੇ ਸਾਰੇ ਹੀ ਕੱਪੜੇ ਕੁਪੜੇ ਧੋਦੇ ਹਾਂ ਅਤੇ ਦਿਵਾਲੀ ਵਾਲ਼ੇ ਦਿਨ ਅਸੀਂ ਘਰੇ ਆਪਣੇ ਲੱਛਮੀ ਪੂਜਾ ਵੀ ਕਰਦੇ ਹਾਂ ਅਤੇ ਦਿਵਾਲੀ ਵਾਲ਼ੇ ਦਿਨ ਅਸੀਂ ਮੇਲਾ ਘੁੰਮ ਕੇ ਪਟਾਕੇ ਲਿਆਉਂਦੇ ਹਾਂ ਅਤੇ ਦਿਵਾਲੀ ਮਨਾਉਂਦੇ ਹਾਂ ਅਤੇ ਘਰਾਂ ਉੱਪਰ ਦੀਵੇ ਲਾਉਂਦੇ ਹਾਂ ਦੀਵਿਆਂ ਵਿੱਚ ਤੇਲ ਪਾ ਕੇ ਦਿਵਾਲੀ ਵਾਲ਼ੇ ਦਿਨ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਮੱਥਾ ਟੇਕਦੇ ਹਾਂ ਉੱਥੇ ਬਹੁਤ ਹੀ ਵਧੀਆ ਲੱਗਦਾ ਹੈ ਦਿਵਾਲੀ ਵਾਲ਼ੇ ਦਿਨ ਅਸੀਂ ਬਹੁਤ ਹੀ ਅਨੰਦ ਮਾਣਦੇ ਹਾਂ ਅਤੇ ਰਾਤੋਂ ਰਾਤ ਪਟਾਕੇ ਵੀ ਬਹੁਤ ਚਲਾਉਂਦੇ ਹਾਂ ਅਤੇ ਅਸੀਂ ਘਰਦਿਆਂ ਨਾਲ਼ ਬਹੁਤ ਹੀ ਖੁਸ਼ੀ ਦਿਵਾਲੀ ਮਨਾਉਂਦੇ ਹਾਂ ਜਿਵੇਂ ਕਿ ਘਰਾਂ ਵਿੱਚ ਵੀ ਬਹੁਤ ਹੀ ਦਿਵਾਲੀ ਮਨਾਈ ਜਾਂਦੀ ਹੈ ਅਸੀਂ ਬਹੁਤ ਹੀ ਦਿਵਾਲੀ ਮਨਾਉਂਦੇ ਹਾਂ ਹਰੇਕ ਤਿਉਹਾਰ ਅਤੇ ਅਸੀਂ ਇੱਦਾ ਹੀ ਮਨਾਉਂਦੇ ਹਾਂ ਲੋਹੜੀ ਵੀ ਅਸੀਂ ਬਹੁਤ ਹੀ ਵਧੀਆ ਮਨਾਉਂਦੇ ਹਾਂ ਜਿਵੇਂ ਕਿ ਲੋਹੜੀ ਵਾਲ਼ੇ ਦਿਨ ਅਸੀਂ ਮੂੰਗਫ਼ਲੀ ਗੱਚਕ ਹੈਂ ਲੈ ਕੇ ਆਉਂਦੇ ਹਾਂ ਅਤੇ ਲੋਹੜੀ ਮਾਤਾ ਨੂੰ ਮੱਥਾ ਟੇਕਦੇ ਹਾਂ ਇਸ ਕਰਕੇ ਅਸੀਂ ਸਾਰੇ ਪਿੰਡ ਵਾਲ਼ੇ ਇਕੱਠੇ ਹੋ ਕੇ ਲੱਕੜੀਆਂ ਇਕੱਠੀਆਂ ਕਰਕੇ ਲੋਹੜੀ ਮਨਾਉਂਦੇ ਹਾਂ ਅਤੇ ਅੱਗ ਬਾਲਦੇ ਹਾਂ ਅਤੇ ਸਾਰਿਆਂ ਨੂੰ ਲੋਹੜੀ ਦਿੰਦੇ ਹਾਂ ਮੈਨੂੰ ਹਰੇਕ ਤਿਉਹਾਰ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਇਸ ਕਰਕੇ ਅਸੀਂ ਸਾਰੇ ਸੱਭਿਆਚਾਰਕ ਤਿਉਹਾਰ ਮਨਾਉਂਦੇ ਹਾਂ